ਮੈਂ ਆਪਣੇ ਕੰਮ 'ਤੇ ਬਾਈਕ ਦੇ ਉੱਤੇ ਜਾਂਦਾ ਹਾਂ ਜੋ ਕਿ ਮੇਰੇ ਘਰ ਤੋਂ ਤਕਰੀਬਨ ਪੰਦਰਾਂ ਤੋਂ ਸਤਾਰਾਂ ਕਿਲੋਮੀਟਰ ਦੂਰ ਹੈ ਉੱਥੇ ਜਾਣ ਲਈ ਮੈਨੂੰ ਬਹੁਤ ਹੀ ਕਈ ਵਾਰ ਖ਼ਰਾਬ ਹਾਲਾਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਖ਼ਰਾਬ ਟਰੈਫਿਕ ਬਹੁਤ ਵਾਰ ਮਿਲਦਾ ਹੈ ਖ਼ਰਾਬ ਟਰੈਫਿਕ ਮਿਲਣ ਕਰਕੇ ਮੈਨੂੰ ਕਾਫ਼ੀ ਲੇਟ ਹੋ ਜਾਂਦਾ ਹਾਂ ਜਿਸ ਕਰਕੇ ਮੇਰਾ ਜੋ ਹੈ ਕਸਟਮਰ ਵੀ ਬਹੁਤ ਖ਼ਰਾਬ ਹੁੰਦਾ ਹੈ ਕਈ ਵਾਰ ਉਹ ਮੈਨੂੰ ਮਿਲੇ ਬਿਨਾਂ ਹੀ ਉੱਥੋਂ ਤੁਰ ਜਾਂਦਾ ਹੈ ਜਿਸ ਕਰਕੇ ਮੈਨੂੰ ਕਾਫ਼ੀ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਕਈ ਵਾਰ ਖ਼ਰਾਬ ਮੌਸਮ ਹੋਣ ਨਾਲ ਵੀ ਮੈਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਆਉਂਦਾ ਹੈ ਬਾਈਕ 'ਤੇ ਜਾਂਦੇ ਸਮੇਂ ਮੈਨੂੰ ਨਾਲ ਰੇਨਕੋਟ ਕੈਰੀ ਅਤੇ ਆਦਿ ਕਰਨਾ ਪੈਂਦਾ ਹੈ ਸਮਾਨ ਖ਼ਰਾਬ ਹੋਣ ਦਾ ਗਿੱਲਾ ਹੋਣ ਦਾ ਵੀ ਡਰ ਬਹੁਤ ਹੁੰਦਾ ਹੈ ਖਸਤਾ ਹਾਲ ਸੜਕਾਂ ਕਰਕੇ ਵੀ ਕਈ ਵਾਰ ਬਹੁਤ ਦਿੱਕਤ ਆਉਂਦੀ ਹੈ ਬਹੁਤ ਹੌਲੀ ਹੌਲੀ ਜਾਣਾ ਪੈਂਦਾ ਹੈ ਜਿਸ ਕਰਕੇ ਮੇਰੇ ਕੰਮ ਦੇ ਵਿੱਚ ਕਈ ਤਰ੍ਹਾਂ ਦਾ ਨੁਕਸਾਨ ਆ ਜਾਂਦਾ ਹੈ ਤੰਗ ਸੜਕਾਂ ਹੋਣ ਨਾਲ ਵੀ ਸ਼ਹਿਰ ਵਾਲੇ ਪਾਸੇ ਜਾ ਕੇ ਬਹੁਤ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ ਕਈ ਵਾਰ ਅੱਗੇ ਜੰਗਲੀ ਜਾਨਵਰ ਕੁੱਤਾ ਬਿੱਲੀ ਆਦਿ ਆ ਜਾਂਦੇ ਹਨ ਜਿਸ ਤੋਂ ਬਚਣ ਲਈ ਕਈ ਵਾਰ ਬੰਦਾ ਡਿੱਗ ਵੀ ਜਾਂਦਾ ਹੈ ਪਰ ਅਸੀਂ ਜੋ ਹੈ ਆਪਣੀ ਸਾਵਧਾਨੀ ਜ਼ਰੂਰ ਵਰਤਣੀ ਪੈਂਦੀ ਹੈ ਅੱਗੋਂ ਦੀ ਧਿਆਨ ਨਾਲ ਹੌਲੀ ਹੌਲੀ ਚਲਾਉਣਾ ਪੈਂਦਾ ਹੈ ਖਿਸਕਣ ਦਾ ਡਰ ਬਹੁਤ ਜ਼ਿਆਦਾ ਹੈ ਤਾਂ ਕਿ ਅਸੀਂ ਆਪਣਾ ਬਚਾ ਖੁਦ ਕਰਨਾ ਹੁੰਦਾ ਹੈ